ਹੈਲੋ ਸੱਸ ਹਾਂਜੀ ਮੈਡਮ ਅੱਛਾ ਜੀ ਓਕੇ ਜੀ ਓਕੇ ਜੀ ਅਤੇ ਮੈਂ ਨਾ ਜੀ ਹਾਂਜੀ ਹਾਂਜੀ ਜ਼ਰੂਰ ਦੇਖ ਲਾਂਗੇ ਜੀ ਮੈਂ ਇਸ ਵਕਤ ਤਾਂ ਦੂਰ ਸੀਗਾ ਜੀ ਹੈ ਨਾ ਅਤੇ ਹਾਂਜੀ ਘੰਟੇ ਦੋ ਘੰਟੇ ਤੱਕ ਦੇਖ ਆ ਕੇ ਦੇਖ ਜਾਂਗੇ ਜੀ ਆਪਣਾ ਐਡਰੈਸ ਕੀ ਹੈ ਜੀ ਕਿੱਥੇ ਕੁ ਪਹੁੰਚਣਾ ਜੀ ਆਪਾਂ ਓਕੇ ਜੀ ਅਤੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਮੈਡਮ ਜ਼ਰੂਰ ਬਸ ਮੈਂ ਘੰਟੇ ਦੋ ਘੰਟੇ ਤੱਕ ਇਧਰੋਂ ਕੰਮ ਫਾਈਨਲ ਕਰਕੇ ਤੁਹਾਡੇ ਕੋਲ ਪਹੁੰਚ ਜਾਊਂਗਾ ਜੀ ਜਾਂ ਜਾਂ ਜੀ ਮੈਨੂੰ ਹਾਂਜੀ ਹਾਂਜੀ ਜਾਂ ਮੈਨੂੰ ਕੋਈ ਮੁੰਡਾ ਮਿਲ ਗਿਆ ਜੀ ਆਪਣਾ ਕੋਈ ਚੇਲਾ ਤਾਂ ਮੈਂ ਉਹਨੂੰ ਦਿਖਾ ਕੇ ਇੱਕ ਵਾਰ ਚੈੱਕ ਕਰਵਾ ਦੂੰਗਾ ਤੁਹਾਡੀ ਬਿਜਲੀ ਕਿਉਂਕਿ ਤੁਹਾਡੇ ਘਰ ਬਿਜਲੀ ਆ ਜਾਵੇਗੀ ਫਿਰ ਹਾਂਜੀ ਮੈਨੂੰ ਇੱਕ ਵਾਰ ਇੱਕ ਵਾਰ ਤੁਸੀਂ ਜਮਾਂ ਕਲੀਅਰ ਕਰਕੇ ਦੱਸ ਸਕਦੇ ਵੀ ਤੁਹਾਡਾ ਜਮਾਂ ਮੀਟਰ ਕੋਲੋ ਹੀ ਧੂੰਆਂ ਨਿਕਲ ਰਿਹਾ ਉਹ ਤਾਰ ਦਾ ਹਾਂਜੀ ਹਾਂਜੀ ਹਾਂ ਠੀਕ ਹੈ ਇੱਕ ਵਾਰੀ ਇੱਕ ਹੋਰ ਵੀ ਚੱਕ ਕਰ ਸਕਦੇ ਜੀ ਕਿਸੇ ਪਾਸੋ ਹੋਰ ਤਾਂ ਨਹੀਂ ਤਾਰ ਤੂਰ ਤਾਂ ਕੱਟੀ ਜਾਂ ਮੂਹਰੋਂ ਸਪਲਾਈ ਮੇਨ ਸਪਲਾਈ ਹੋ ਗਈ ਓਕੇ ਹਾਂਜੀ ਹਾਂਜੀ ਮੈਡਮ ਜ਼ਰੂਰ ਮੈਡਮ ਜ਼ਰੂਰ ਬਸ ਫਾਈਨਲ ਕਰਕੇ ਨਾ ਘੰਟੇ ਡੇਢ ਘੰਟੇ ਦੇ ਵਿੱਚ ਤੁਹਾਡੇ ਕੋਲ ਪਹੁੰਚ ਜਾਵਾਂਗੇ ਓ ਓਕੇ ਮੈਡਮ ਓਕੇ ਓਕੇ